ਅੱਜ ਕੱਲ੍ਹ ਤਾਂ ਪੰਜਾਬ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ ਅਤੇ ਸਰਕਾਰਾਂ ਨੇ ਬਹੁਤ ਚੰਗਾ ਕੰਮ ਵੀ ਕੀਤਾ ਹੈ ਸਭ ਤੋਂ ਜ਼ਿਆਦਾ ਪੜ੍ਹਾਈ ਦੇ ਖੇਤਰ ਵਿੱਚ ਅਤੇ ਹੈਲਥ ਦੇ ਖੇਤਰ ਵਿੱਚ ਸਰਕਾਰਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਿਸ ਕਾਰਨ ਪੰਜਾਬ ਦੇ ਹਸਪਤਾਲਾਂ ਨੂੰ ਜਾਂ ਕਲੀਨਿਕਾਂ ਨੂੰ ਬਹੁਤ ਵਧੀਆ ਬਣਾ ਚੁੱਕੇ ਹਨ ਉੱਥੇ ਸਟਾਫ ਦੀ ਵੀ ਅੱਜ ਕੱਲ੍ਹ ਕੋਈ ਕਮੀ ਨਹੀਂ ਰਹਿੰਦੀ ਹੈ ਅਤੇ ਬਹੁਤ ਵਧੀਆ ਵਧੀਆ ਉਪਕਰਨਾਂ ਨਵੀਆਂ ਨਵੀਆਂ ਵਿਦੇਸ਼ੀ ਦਵਾਈਆਂ ਵੀ ਪੰਜਾਬ ਵਿੱਚ ਆਉਂਦੀਆਂ ਹਨ ਤਾਂ ਕਿ ਮਰੀਜ਼ਾਂ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ ਅਤੇ ਮਰੀਜ਼ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ ਅੱਜ ਕੱਲ੍ਹ ਪੰਜਾਬ ਵਿੱਚ ਹੋਰ ਵੀ ਬਹੁਤ ਜ਼ਿਆਦਾ ਤਰੀਕਿਆਂ ਦੀਆਂ ਬਿਮਾਰੀਆਂ ਫੈਲ ਚੁੱਕੀਆਂ ਹਨ ਜਿਸ ਦਾ ਕੋਈ ਇਲਾਜ ਵੀ ਨਹੀਂ ਹੁੰਦਾ ਹੈ ਅਤੇ ਇਹ ਵਿਦੇਸ਼ਾਂ ਤੋਂ ਆਈ ਬਿਮਾਰੀਆਂ ਵੀ ਹਨ ਕਈ ਇਹਨਾਂ ਲਈ ਵੀ ਪੰਜਾਬ ਸਰਕਾਰ ਨੇ ਵਿਦੇਸ਼ਾਂ ਤੋਂ ਬਹੁਤ ਦਵਾਈਆਂ ਮੰਗਵਾਈਆਂ ਹਨ ਅਤੇ ਇਹਨਾਂ ਦਵਾਈਆਂ ਦੇ ਨਾਲ ਹੀ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਕਿ ਲੋਕ ਛੇਤੀ ਤੋਂ ਛੇਤੀ ਠੀਕ ਹੋ ਸਕਣ